ਸਾਡੇ ਮੇਰੇ ਜੋ ਪੁਰਾਣੇ ਬਜ਼ੁਰਗਾਂ ਦੁਆਰਾ ਸਿੱਕੇ ਅੱਜ ਤੋਂ ਪਹਿਲਾਂ ਦੇ ਸਾਂਭ ਕੇ ਰੱਖੇ ਆ ਜੋ ਅੱਜ ਵੀ ਮੇਰੇ ਕੋਲ ਹਨ ਮੈਂ ਉਹਨਾਂ ਸਿੱਕਿਆਂ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਤਾਂਕਿ ਸਾਨੂੰ ਪੁਰਾਣੇ ਸਮਿਆਂ ਦੀ ਯਾਦ ਦਿਲਾਉਂਦੇ ਰਹਿਣ ਸਾਡੇ ਬਜ਼ੁਰਗਾਂ ਦੀ ਯਾਦ ਆਉਂਦੀ ਰਹੇ ਕਿ ਸਾਡੇ ਪੁਰਾਣੇ ਬਜ਼ੁਰਗ ਇਹ ਸਿੱਕੇ ਵਰਤਦੇ ਸੀ ਔਰ ਮੈਂ ਚਾਹੁੰਦਾ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਔਰ ਪੁਸ਼ਤਾਂ ਤੱਕ ਉਹ ਚੀਜ਼ਾਂ ਉਹਨਾਂ ਤਕ ਪਹੁੰਚਾਈਆਂ ਜਾ ਸਕਣ ਬੱਚੇ ਅੱਗੇ ਆਉਣ ਆਲੇ ਸਾਂਭ ਕੇ ਰੱਖਣ